ਹਾਂਜੀ ਅਸੀਂ ਆਟੋਮੈਟਿਕ ਅਨੁਵਾਦ ਜਾਂ ਗੂਗਲ ਮੈਪਸ ਦੀ ਵਰਤੋਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਰਦੇ ਹਾਂ ਮੇਰੇ ਮੁਤਾਬਕ ਇਹ ਕਿਸੇ ਗਿਆਨਹੀਨ ਵਿਅਕਤੀ ਲਈ ਬਹੁਤ ਵੱਡਾ ਯੋਗਦਾਨ ਪ੍ਰਾਪਤ ਕਰਦੇ ਹਨ ਜਿਸ ਰਾਹੀਂ ਸਾਨੂੰ ਨਿੱਜੀ ਤੌਰ 'ਤੇ ਕਿਸੇ ਵਿਅਕਤੀ ਉੱਪਰ ਨਿਰਭਰ ਹੋਣ ਦੀ ਲੋੜ ਨਹੀਂ ਪੈਂਦੀ ਇਹ ਗੂਗਲ ਮੈਪਸ ਕਾਫੀ ਹੱਦ ਤੱਕ ਸਹੀ ਹਨ ਪਰ ਕਈ ਵਾਰ ਗੂਗਲ ਮੈਪ ਸਾਨੂੰ ਬਹੁਤ ਜ਼ਿਆਦਾ ਉਲਝਾ ਵਿੱਚ ਪਾ ਦਿੰਦੇ ਹਨ ਜਿਸ ਤਰ੍ਹਾਂ ਇੱਕ ਭੁੱਲ ਭੁਲੱਈਆ ਰਾਹੀਂ ਅਸੀਂ ਗੇੜੇ ਮਾਰ ਕੇ ਦੁਬਾਰਾ ਉਸ ਕੇਂਦਰਿਤ ਬਿੰਦੂ ਉੱਪਰ ਹੀ ਆ ਕੇ ਪਹੁੰਚਦੇ ਹਾਂ ਕਈ ਵਾਰ ਗੂਗਲ ਮੈਪਸ ਰਾਹੀਂ ਅਸੀਂ ਇੱਕ ਛੋਟੀ ਜਿਹੀ ਜਗ੍ਹਾ 'ਤੇ ਪਹੁੰਚਣ ਲਈ ਵਿਅਰਥ ਦੇ ਪੰਦਰ੍ਹਾਂ ਵੀਹ ਮਿੰਟ ਖਰਾਬ ਕਰ ਦਿੰਦੇ ਹਾਂ ਪਰ ਇੱਕ ਅਣਜਾਣ ਵਿਅਕਤੀ ਜਿਸ ਨੂੰ ਕਿ ਨਵੀਂ ਜਗ੍ਹਾ ਦਾ ਪਤਾ ਹੀ ਨਹੀਂ ਹੁੰਦਾ ਉਹ ਇਸ ਦੀ ਮਦਦ ਨਾਲ ਆਪਣੀ ਮੰਜ਼ਿਲ ਉੱਤੇ ਬੜੇ ਆਰਾਮ ਨਾਲ ਪਹੁੰਚ ਜਾਂਦਾ ਹੈ ਇਸ ਆਟੋਮੈਟਿਕ ਅਨੁਵਾਦ ਗੂਗਲ ਮੈਪ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਸ ਰਾਹੀਂ ਯਾਤਰਾ ਕਰਨੀ ਬਹੁਤ ਹੀ ਸੌਖੀ ਹੋ ਗਈ ਹੈ ਇਸ ਨਾਲ ਬਹੁਤ ਸਮੇਂ ਦੀ ਬੱਚਤ ਵੀ ਹੁੰਦੀ ਹੈ ਅਤੇ ਅਸੀਂ ਅਣਜਾਣ ਵਿਅਕਤੀਆਂ ਦੇ ਜਾਲ ਵਿੱਚ ਫਸਣ ਤੋਂ ਵੀ ਬਚ ਜਾਂਦੇ ਹਾਂ ਧੰਨਵਾਦ